ਆਪਣੇ ਜੀਵਨ ਵਿੱਚ ਵੱਖ ਵੱਖ ਤਰ੍ਹਾਂ ਦੇ ਕਸਰਤ ਕਰਨ ਦੇ ਤਰੀਕੇ ਹਨ ਜਿਹਨਾਂ ਵਿੱਚੋਂ ਇੱਕ ਜਿਹੜਾ ਸਾਈਕਲਿੰਗ ਕਰਨ ਦਾ ਤਰੀਕਾ ਹੈ ਉਹ ਬਹੁਤ ਹੀ ਲੋਕਾਂ ਦਾ ਮਨਭਾਉਂਦਾ ਕਸਰਤ ਕਰਨ ਦਾ ਤਰੀਕਾ ਹੈ ਕਸਰਤ ਜਿਹੜੀ ਸਾਈਕਲਿੰਗ ਹੈ ਇਸ ਨਾਲ ਕਿ ਆਪਣੇ ਸਾਰੇ ਸਰੀਰ ਦੀ ਮੂਵਮੈਂਟ ਹੁੰਦੀ ਹੈ ਖਾਸ ਕਰਕੇ ਲੱਤਾਂ ਦੀ ਜਿਹੜੀ ਥਾਈ ਮੂਵਮੈਂਟ ਹੈ ਉਸ ਨੂੰ ਬਹੁਤ ਅਰਾਮ ਮਿਲਦਾ ਹੈ ਇਸ ਲਈ ਸਾਈਕਲ ਚਲਾਉਣ ਲੱਗੇ ਆਪਾਂ ਨੂੰ ਬਹੁਤ ਚੀਜ਼ਾਂ ਦਾ ਸੁਰੱਖਿਆ ਦੇ ਤੌਰ 'ਤੇ ਧਿਆਨ ਰੱਖਣਾ ਚਾਹੀਦਾ ਹੈ ਵੀ ਆਪਾਂ ਸਾਈਕਲ ਟਰੈਕ 'ਤੇ ਹੀ ਸਾਈਕਲ ਚਲਾਇਆ ਜਾਵੇ ਤਾਂ ਕਿ ਹੋਰ ਸਾਧਨ ਆਪਾਂ ਨੂੰ ਨਾ ਟੱਕਰ ਟਕਰਾ ਦੇ ਸਕੇ ਅਤੇ ਗਰੁੱਪ ਸਾਈਕਲਿੰਗ ਹੀ ਸਭ ਤੋਂ ਬੈਸਟ ਸਾਈਕਲਿੰਗ ਹੈ ਜਿਸ ਵਿੱਚ ਆਪਾਂ ਨੂੰ ਕਦੇ ਮੁਸੀਬਤ ਆਉਣ 'ਤੇ ਅਕੇਲਾਪਣ ਨਹੀਂ ਲੱਗੇਗਾ ਲੋਕਾਂ ਦਾ ਸਾਥ ਜਾਂ ਹੋਰ ਬੱਚਿਆਂ ਸਾਈਕਲਿਸਟ ਦਾ ਸਾਥ ਆਪਾਂ ਨੂੰ ਲਗਾਤਾਰ ਮਿਲਦਾ ਹੀ ਰਹੇਗਾ ਸਾਈਕਲਿੰਗ ਚਲਾਉਣ ਲੱਗੇ ਆਪਾਂ ਨੂੰ ਪੂਰਾ ਅਲਰਟ ਰਹਿਣਾ ਚਾਹੀਦਾ ਹੈ ਅਤੇ ਸੱਜੇ ਖੱਬੇ ਦੇਖ ਕੇ ਓਵਰਟੇਕ ਕਰਨ ਲੱਗੇ ਬਹੁਤ ਹੀ ਧਿਆਨ ਨਾਲ ਦੇਖਣਾ ਚਾਹੀਦਾ ਹੈ ਸਾਈਕਲਿੰਗ ਦੀ ਲਿਮਿਟ ਸਪੀਡ 'ਤੇ ਹੀ ਸਾਈਕਲ ਨੂੰ ਚਲਾਉਣਾ ਚਾਹੀਦਾ ਹੈ ਕੋਸ਼ਿਸ਼ ਕੀਤਾ ਜਾਵੇ ਕਿ ਜਿਹੜੇ ਵੱਡੇ ਸਾਧਨ ਹੈ ਉਸਨੂੰ ਓਵਰਟੇਕ ਨਾ ਕੀਤਾ ਜਾਵੇ ਆਪਦੇ ਸਾਈਕਲ ਟਰੈਕ ਦੇ ਵਿੱਚ ਹੀ ਸਾਈਕਲ ਨੂੰ ਚਲਾਇਆ ਜਾਵੇ ਅਤੇ ਬਹੁਤ ਹੀ ਧਿਆਨ ਨਾਲ ਸਾਈਕਲ ਚਲਾਉਣਾ ਚਾਹੀਦਾ ਹੈ ਕੁਛ ਦਸਤਾਵੇਜ਼ ਆਪਾਂ ਨੂੰ ਨਾਲ ਲੈ ਕੇ ਵੀ ਚੱਲਣਾ ਚਾਹੀਦਾ ਜਿਵੇਂ ਹਵਾ ਵਾਲਾ ਪੰਪ ਪਾਣੀ ਦੀ ਬੋਤਲ ਗਲੈਡ ਰੈਡੀਏਟਰ ਵਾਲੇ ਜੈਕਿਟਸ ਪਾ ਕੇ ਹੀ ਸਫਰ ਕਰਨਾ ਚਾਹੀਦਾ ਹੈ ਅਤੇ ਹੋਰ ਵੀ ਜਿਵੇਂ ਸਾਈਕਲਿਸਟ ਗੋਗਲਸ ਹੋ ਗਏ ਐਨਕਾਂ ਟੋਪੀ ਹੈਲਮਟ ਇਹ ਸਾਰੇ ਦਸਤਾਵੇਜ਼ ਆਪਾਂ ਨੂੰ ਨਾਲ ਰੱਖਣੇ ਚਾਹੀਦੇ ਹਨ ਤਾਂ ਕਿ ਜਦੋਂ ਵੀ ਆਪਾਂ ਨੂੰ ਮੁਸੀਬਤ ਪਵੇ ਤਾਂ ਆਪਾਂ ਨੂੰ ਕਿਸੇ ਵੱਲ ਦੇਖਣਾ ਨਾ ਪਵੇ ਆਪਾਂ ਆਪਦੀ ਜ਼ਰੂਰਤ ਦੇ ਮੁਤਾਬਕ ਚੀਜ਼ ਦੀ ਲੋੜ ਨਾਲ ਸਹੀ ਕਰਕੇ ਉਸਨੂੰ ਅੱਗੇ ਆਪਾਂ ਵੱਧ ਸਕਦੇ ਹਾਂ ਇਸ ਲਈ ਸਾਈਕਲ ਇੱਕ ਬਹੁਤ ਵਧੀਆ ਸਾਧਨ ਹੈ ਇਸ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ ਅਧਿਆਪਕਾਂ ਨੂੰ ਸਾਰਿਆਂ ਨੂੰ ਇਹਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਸ ਨੂੰ ਧਿਆਨ ਨਾਲ ਚਲਾਉਣਾ ਚਾਹੀਦਾ ਹੈ